ਹੈਲੋ ਹਾਂਜੀ ਹਾਂਜੀ ਹਾਂਜੀ ਪੇਂਟਰ ਤੋਂ ਬੋਲ ਰਿਹਾ ਜੀ ਹਾਂਜੀ ਦੱਸੋ ਅੱਛਾ ਜੀ ਅੱਛਾ ਜੀ ਹਾਂਜੀ ਮੈਡਮ ਜੀ ਪੇਂਟ ਕਰ ਦਿਆਂਗੇ ਪੁੱਟੀ ਭਰਾਈ ਹੋਈ ਜੀ ਤੁਸੀਂ ਪਹਿਲਾਂ ਪੁੱਟੀ ਪੁੱਟੀ ਅੱਛਾ ਜੀ ਅਤੇ ਤੁਸੀਂ ਫਿਰ ਹੁਣ ਪੇਂਟ ਦੇ ਨਾਲ ਫਿਰ ਪੁੱਟੀ ਪਹਿਲਾਂ ਭਰਾਉਣੀ ਪੈਣੀ ਹੈ ਤੁਹਾਨੂੰ ਅਤੇ ਦੱਸੋ ਫਿਰ ਪੁੱਟੀ ਭਰਾ ਨਾਲ ਭਰੋਗੇ ਤਾਂ ਹੀ ਹੋਵੇਗਾ ਕੰਮ ਹਾਂਜੀ ਪਹਿਲਾਂ ਪੁੱਟੀ ਭਰਨੀ ਪੈਣੀ ਹੈ ਜੀ ਅਤੇ ਪੁੱਟੀ ਭਰ ਕੇ ਅਤੇ ਉਸ ਤੋਂ ਬਾਅਦ ਪੇਂਟ ਹੋਵੇਗਾ ਅਤੇ ਪੇਂਟ ਤੁਸੀਂ ਜਿਹੜੇ ਕਲਰ ਦਾ ਕਹੋਗੇ ਉਸ ਕਲਰ ਦਾ ਕਰ ਦਿਆਂਗੇ ਅਤੇ ਸਾਰੇ ਕਮਰਿਆਂ ਦੇ ਵਿੱਚੋਂ ਇੱਕੋ ਜਿਹਾ ਰੰਗ ਕਰਨਾ ਤਾਂ ਇੱਕੋ ਜਿਹਾ ਹੋ ਜਾਵੇਗਾ ਵੱਖਰਾ ਵੱਖਰਾ ਕਹੋਗੇ ਤਾਂ ਵੱਖਰਾ ਹੋ ਜਾਵੇਗਾ ਫਰੰਟ ਦੇ ਉੱਤੇ ਅਸੀਂ ਤੁਹਾਡਾ ਘਰ ਵਿਜਿਟ ਕਰ ਲਵਾਂਗੇ ਅਤੇ ਫਿਰ ਅਸੀਂ ਤੁਹਾਨੂੰ ਦੱਸ ਦਾਂਗੇ ਫਰੰਟ ਦੇ ਵਿੱਚੋਂ ਕਿਹੜੀ ਯਾਨੀ ਕਿ ਅਸੀਂ ਰੰਗ ਦੀ ਆਪਸ਼ਨਾਂ ਅਵੇਲੇਬਲ ਹੋਣਗੀਆਂ ਤੁਹਾਡੇ ਲਈ ਅਤੇ ਉਹ ਕਲਰ ਹੋ ਜਾਵੇਗਾ ਅਤੇ ਇਸ ਤੋਂ ਇਲਾਵਾ ਜਿਹੜਾ ਹੋਵੇਗਾ ਆਪਣੇ ਅੰਦਰ ਰੂਮਸ ਦੇ ਵਿੱਚ ਕਮਰਿਆਂ ਦੇ ਵਿੱਚ ਉਹ ਤੁਹਾਡੀ ਮਰਜ਼ੀ ਹੋਵੇਗੀ ਉਦੋਂ ਅਸੀਂ ਤੁਹਾਨੂੰ ਦੱਸ ਦਾਂਗੇ ਅਤੇ ਬਾਹਰਲੇ ਪਾਸੇ ਜਿਹੜਾ ਹੁੰਦਾ ਉਹ ਜ਼ਿਆਦਾਤਰ ਪਲਾਸਟਿਕ ਪੇਂਟ ਕਰਾਏ ਜਾਂਦੇ ਜੀ ਉਹ ਤੁਸੀਂ ਵੇਖ ਲਓ ਹੁਣ ਪਲਾਸਟਿਕ ਪੇਂਟ ਕਰਾਣਾ ਨੋਰਮਲ ਕਰਾਉਣਾ ਜੀ ਪਲਾਸਟਿਕ ਪੇਂਟ ਦਾ ਖਰਚਾ ਵੱਧ ਪੈਂਦਾ ਜੀ ਅਤੇ ਆਹ ਚੀਜ਼ਾਂ ਹੈਗੀਆਂ ਸਮਾਨ ਤੁਸੀਂ ਲਓਗੇ ਕਿ ਅਸੀਂ ਲੈ ਕੇ ਆਓਗੇ ਠੇਕੇ 'ਤੇ ਦਿਓਗੇ ਕਿ ਯਾਨੀ ਕਿ ਦਿਹਾੜੀ 'ਤੇ ਕਰਾਓਗੇ ਜੀ ਠੇਕੇ 'ਤੇ ਜੀ ਹਾਂਜੀ ਠੇਕੇ 'ਤੇ ਜੇ ਸਮਾਨ ਤੁਸੀਂ ਲੈ ਕੇ ਆਓਗੇ ਤਾਂ ਸਾਡਾ ਠੇਕਾ ਹੋਵੇਗਾ ਪਰ ਸਕੇਅਰ ਫੁੱਟ ਦਾ ਛੇ ਰੁਪਏ ਜੀ ਅਤੇ ਜੇ ਸਮਾਨ ਅਸੀਂ ਲੈ ਕੇ ਆਵਾਂਗੇ ਤਾਂ ਨੈਰੋਲੈਕਸ ਕੰਪਨੀ ਦਾ ਪੇਂਟ ਵਰਤਾਂਗੇ ਜੇ ਕੇ ਦੀ ਪੁੱਟੀ ਵਰਤ ਦਿਆਂਗੇ ਅਤੇ ਸਾਰਾ ਯਾਨੀ ਕਿ ਅਸੀਂ ਪੰਦਰ੍ਹਾਂ ਰੁਪਏ ਸਕੇਅਰ ਫੁੱਟ ਦੇ ਵਿੱਚ ਕਰਕੇ ਦਿਆਂਗੇ ਅਤੇ ਤੁ ਤੁਹਾਨੂੰ ਯਾਨੀ ਕਿ ਬਸ ਕੁਝ ਵੀ ਨਹੀਂ ਕਰਨਾ ਸਾਰਾ ਕੁਝ ਸਾਡਾ ਹੋਵੇਗਾ ਤੁਹਾਡੇ ਸਾਹਮਣੇ ਜੈਨੁਅਨ ਸਮਾਨ ਕੰਪਨੀ ਦਾ ਅਸਲ ਦੇ ਵਿੱਚ ਬਿੱਲ ਸਾਰਾ ਕੁਝ ਲਿਆ ਕੇ ਕਰ ਦਿਆਂਗੇ ਜੀ ਹਾਂਜੀ ਅਸੀਂ ਤੁਹਾਡੇ ਕੋਲ ਜੀ ਕੱਲ੍ਹ ਸ਼ਾਮ ਨੂੰ ਆ ਜਾਂਗੇ ਚਾਰ ਕੁ ਵਜੇ ਸਾਰਾ ਕੁਝ ਵੇਖ ਲਿਆਂਗੇ ਮੌਕੇ 'ਤੇ ਅਤੇ ਬਾਕੀ ਰੇਟ ਰੇਟ ਦਾ ਅਸੀਂ ਤੁਹਾਨੂੰ ਦੱਸ ਦਿੱਤਾ ਅਤੇ ਜਾਨੀ ਕਿ ਅਸੀਂ ਕਰ ਦਿਆਂਗੇ ਜਿਵੇਂ ਤੁਸੀਂ ਦੱਸਿਆ ਤਿੰਨ ਮਹੀਨੇ ਲੱਗਣਗੇ ਸਾਰਾ ਕੁਝ ਕੰਪਲੀਟ ਹੋਣ ਦੇ ਵਿੱਚ

ਹਾਂਜੀ ਅਸੀਂ ਕੱਲ੍ਹ ਸ਼ਾਮ ਨੂੰ ਆ ਜਾਂਗੇ ਤੁਹਾਡੇ ਅਤੇ ਉਦੋਂ ਸਾਰਾ ਕੁਝ ਵੇਖ ਕੇ ਤੁਹਾਨੂੰ ਸਾਰਾ ਕੁਛ ਹੀ ਦੱਸ ਦਿਆਂਗੇ ਏ ਟੂ ਜ਼ੈਡ ਕਿੰਨਾ ਟਾਈਮ ਲੱਗੇਗਾ ਅਤੇ ਕਲਰ ਦੀ ਅਸੀਂ ਲਿਆਵਾਂਗੇ ਇੱਕ ਆਉਂਦੀ ਹੈ ਜੀ ਕਾਪੀ ਉਹਦੇ ਵਿੱਚ ਸਾਰੇ ਰੰਗ ਹੁੰਦੇ ਆ ਜੀ ਤੁਸੀਂ ਦੱਸ ਦਿਆ ਜੇ ਜਿਹੜਾ ਤੁਹਾਨੂੰ ਚੰਗਾ ਲੱਗੇ